ਹੈਲੋ ਸਰ ਮੈਂ ਹੁਣੇ ਤੁਹਾਨੂੰ ਆਪਣੇ ਖਾਣੇ ਦਾ ਔਡਰ ਦਿਆ ਸੀ ਉਸ ਵਿੱਚ ਮੈਂ ਕੁਛ ਹੋਰ ਚੀਜ਼ਾਂ ਐਡ ਕਰਵਾਉਣਾ ਚਾਹੁੰਦੀ ਹਾਂ ਅਗਰ ਤੁਹਾਡੇ ਕੋਲ ਅਵੇਲੇਬਲ ਹੈ ਤਾਂ ਤੁਸੀਂ ਪਲੀਜ਼ ਉਹਦੇ ਵਿੱਚ ਜੂਸ ਔਰੰਜ ਜੂਸ ਵਗੈਰਾ ਔਰ ਜੇ ਹੋ ਸਕਦਾ ਨੂਡਲਸ ਵਗੈ ਨੂਡਲਸ ਹੋ ਗਏ ਔਰ ਕੁਛ ਹੋਰ ਸਾਊਥ ਇੰਡੀਅਨ ਡਿਸ਼ ਹੈ ਤਾਂ ਉਹ ਐਡ ਕਰ ਦਿਉ ਪਲੀਜ਼ ਔਰ